ਮੋਬਾਇਲ ਫੋਨ ਅੱਜ ਦੀ ਤਕਨੋਲਜੀ ਦਾ ਸਭ ਤੋਂ ਵੱਧ ਇਸਤੇਮਾਲ ਹੋਣ ਵਾਲੀ ਇੱਕ ਤਕਨੋਲੋਜੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਵਰਤੋਂ ਦੇ ਵਿੱਚ ਆਈ ਮੰਨੀ ਜਾਣ ਵਾਲੀ ਤਕਨੋਲਜੀ ਹੈ ਅੱਜ ਦੇ ਸਮੇਂ ਦੇ ਵਿੱਚ ਅਸੀਂ ਹਰ ਇੱਕ ਬੱਚੇ ਤੋਂ ਬੁੱਢੇ ਨੂੰ ਮੋਬਾਇਲ ਫੋਨ ਦੀ ਵਰਤੋਂ ਕਰਦੇ ਆਮ ਤੌਰ 'ਤੇ ਦੇਖ ਸਕਦੇ ਹਾਂ ਪਰ ਮੇਰਾ ਮੰਨਣਾ ਹੈ ਕਿ ਹਰ ਵਿਅਕਤੀ ਨੂੰ ਘੱਟੋ ਘੱਟ ਆਪਣੇ ਬੱਚੇ ਨੂੰ ਮੋਬਾਈਲ ਫੋਨ ਅਠਾਰਾਂ ਦੀ ਉਮਰ ਤੱਕ ਲਾਜ਼ਮੀ ਹੋਣ ਤੋਂ ਬਾਅਦ ਦੇਣਾ ਚਾਹੀਦਾ ਹੈ ਕਿਉਂਕਿ ਮੋਬਾਇਲ ਫੋਨ 'ਤੇ ਬਹੁਤ ਹੀ ਉਪਵਰਤੋਂ ਵੀ ਕੀਤੇ ਜਾਂਦੇ ਹਨ ਅਤੇ ਬਹੁਤ ਹੀ ਮਾੜੀ ਵਰਤੋਂ ਵੀ ਹੋ ਸਕਦੀ ਹੈ ਜੋ ਕਿ ਹਰ ਅ ਹਰ ਸਮੇਂ ਦੇ ਲਈ ਸਹੀ ਨਹੀਂ ਹੈ ਪਰ ਅ ਸਾਡਾ ਮੰਨਣਾ ਇਹ ਹੈ ਕਿ ਮੋਬਾਈਲ ਫੋਨ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਦੇ ਵਿੱਚ ਵੀ ਸ਼ਾਮਲ ਹੋਣਾ ਚਾਹੀਦਾ ਹੈ ਬੱਚਿਆਂ ਨੂੰ ਮੋਬਾਈਲ ਫੋਨ ਦੀ ਇੱਕ ਇੱਕ ਵੱਖਰੇ ਤਰੀਕੇ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਕਿ ਉਪਲਾਭ ਜਿਸ ਦੇ ਨਾਲ ਉਹ ਉਹ ਆਪਣੇ ਵਕਤ ਨੂੰ ਸਾਂਭ ਕੇ ਮੋਬਾਇਲ ਫੋਨ ਨੂੰ ਘੱਟ ਵਰਤ ਕੇ ਤੇ ਅਤੇ ਸਰੀਰਿਕ ਖੇਡਾਂ ਦੇ ਨਾਲ ਜੁੜਨ ਜਿਸ ਦੇ ਨਾਲ ਮੋਬਾਇਲ ਫੋਨ ਅਤੇ ਸਰੀਰਿਕ ਖੇਡਾਂ ਦਾ ਸੰਤੁਲਨ ਬਣਿਆ ਰਹੇ ਤਾਂ ਕਿ ਉਹ ਮੋਬਾਇਲ ਫੋਨ ਦਾ ਉਪਲਾਭ ਵੀ ਨਾ ਉਠਾਉਣ ਅਤੇ ਸਰੀਰਿਕ ਖੇਡਾਂ ਦਾ ਧਿਆਨ ਵੀ ਦੇਣ ਅਤੇ ਇਸ ਨੂੰ ਮੁਕੰਮਲ ਕਰਨ ਦੇ ਵਿੱਚ ਉਹਨਾਂ ਦੇ ਮਾਂ ਪਿਓ ਦਾ ਸਭ ਤੋਂ ਜ਼ਿਆਦਾ ਮੰਤਵ ਹੈ ਜੋ ਕਿ ਆਪਣੇ ਅ ਬੱਚਿਆਂ ਨੂੰ ਇਸ ਫੋਨ ਤੋਂ ਰੋਕ ਕੇ ਅਤੇ ਸਰੀਰਿਕ ਖੇਡਾਂ ਦੇ ਨਾਲ ਜੋੜ ਸਕਦੇ ਹਨ